ਮਾਈਗਰੇਨ ਤੋਂ ਆਪਣੇ ਆਪ ਨੂੰ ਬਚਾਉਣ ਅਤੇ ਪ੍ਰਭਾਵਸ਼ਾਲੀ ਹੱਲ ਲੱਭਣ ਲਈ ਇੱਕ ਬਹੁਪੱਖੀ ਪਹੁੰਚ ਅਪਣਾਉਣੀ ਜ਼ਰੂਰੀ ਹੈ ਜੋ ਰੋਕਥਾਮ ਅਤੇ ਪ੍ਰਬੰਧਨ ਦੋਵਾਂ ਨੂੰ ਸੰਬੋਧਿਤ ਕਰਦਾ ਹੈ ਪਹਿਲਾਂ ਤਣਾਅ ਕੁਝ ਭੋਜਨ ਜਿਵੇਂ ਕੈਫੀਨ ਚਾਕਲੇਟ ਅਤੇ ਪੁਰਾਣੀ ਚੀਜ਼ ਅਤੇ ਵਾਤਾਵਰਨ ਕਾਰਕ ਜਿਵੇਂ ਕਿ ਤੇਜ਼ ਗੰਧ ਅਤੇ ਚਮਕਦਾਰ ਰੋਸ਼ਨੀ ਵਰਗੇ ਆਮ ਟਰੈਗਰਾਂ ਦੀ ਪਛਾਣ ਕਰੋ ਅਤੇ ਬਚੋ ਇੱਕ ਅਨੁਸੂਚੀ ਨੂੰ ਬਣਾਈ ਰੱਖਣਾ ਅਤੇ ਹਾਈਡਰੇਟਡ ਰਹਿਣ ਦੀ ਮਾਈਗ੍ਰੇਨ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ ਆਰਾਮ ਦੀਆਂ ਤਕਨੀਕਾਂ ਜਿਵੇਂ ਕਿ ਯੋਗਾ ਧਿਆਨ ਡੂੰਘੇ ਸਾਹ ਲੈਣ ਦੇ ਅਭਿਆਸਾਂ ਨੂੰ ਸ਼ਾਮਿਲ ਕਰਨਾ ਤਣਾਅ ਦਾ ਪ੍ਰਬੰਧਨ ਕਰ ਸਕਦਾ ਹੈ ਮਾਈ ਮਾਈਗ੍ਰੇਨ ਦੀ ਬਾਰੰਬਾਰਤਾ ਨੂੰ ਘਟਾ ਸਕਦਾ ਹੈ ਇਸ ਤੋਂ ਇਲਾਵਾ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਜਿਵੇਂ ਕਿ ਸੰਤੁਲਿਤ ਭੋਜਨ ਖਾਣਾ ਛੱਡੇ ਗਏ ਭੋਜਨ ਤੋਂ ਪਰਹੇਜ਼ ਕਰਨਾ ਪੁਰਾਣੀਆਂ ਸਥਿਤੀਆਂ ਉਦਾਹਰਣ ਲਈ ਹਾਈਪਰਟੈਸ਼ਨ ਦਾ ਪ੍ਰਬੰਧ ਕਰਨਾ ਮਹੱਤਵਪੂਰਨ ਹੈ ਟਰੈਗਰਾਂ ਲੱਛਣਾਂ ਅਤੇ ਪ੍ਰਭਾਵੀ ਇਲਾਜ ਨੂੰ ਟਰੈਕ ਕਰਨ ਲਈ ਮਾਈਗਰੇਨ ਡਾਇਰੀ ਰੱਖਣਾ ਬਿਹਤਰ ਪ੍ਰਬੰਧਨ ਲਈ ਸਮਝ ਪ੍ਰਦਾਨ ਕਰ ਸਕਦਾ ਹੈ ਉਹਨਾਂ ਮਾਮਲਿਆਂ ਵਿੱਚ ਜਿੱਥੇ ਮਾਈਗ੍ਰੇਨ ਅਕਸਰ ਜਾਂ ਗੰਭੀਰ ਹੁੰਦੇ ਹਨ ਇੱਕ ਨਿਓਰੋਲੋਜਿਸਟ ਜਾਂ ਸਿਰ ਦਰਦ ਦੇ ਮਾਹਿਰ ਤੋਂ ਪੇਸ਼ੇਵਰ ਸਲਾਹ ਲੈਣ ਨਾਲ ਰੋਕਥਾਮ ਵਾਲੀਆਂ ਦਵਾਈਆਂ ਜਾਂ ਵਿਕਲਪ ਇਲਾਜ ਜਿਵੇਂ ਕਿ ਬੌਧਾਤਮਿਕ ਵਿਵਹਾਰਕ ਥਰੈਪੀ ਸੀ ਵੀ ਟੀ ਜਾਂ ਬਾਇਓ ਫੀਡਬੈਕ ਅਤੇ ਅਨੁਕੂਲ ਇਲਾਜ ਯੋਜਨਾਵਾਂ ਬਣ ਸਕਦੀਆਂ ਹਨ